ਆਪਣੀ ਆਵਾਜ਼ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦੀ ਹਾਂ ਕਿ ਖੱਟੀਆਂ ਚੀਜ਼ਾਂ ਘੱਟ ਖਾਦੀਆਂ ਜਾਣ ਜਿਵੇਂ ਕਿ ਸੋਸ ਜਿਹੜਾ ਹੈ ਜਾਂ ਚਟਣੀਆਂ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਘੱਟ ਕੀਤੀ ਜਾਵੇ ਉਸਦੇ ਨਾਲ ਹੀ ਹਮੇਸ਼ਾ ਕੋਸੇ ਪਾਣੀ ਦਾ ਜਿਹੜੀ ਵਰਤੋਂ ਹੈ ਉਹ ਕਰਨੀ ਚਾਹੀਦੀ ਹੈ ਹੋਰ ਜਿਹੜਾ ਕੁਝ ਇਹਦੇ 'ਚ ਕੀਤਾ ਜਾ ਸਕਦਾ ਉਹ ਇਹ ਹੈ ਕੀ ਗਾਰਗਲਸ ਕੀਤੇ ਜਾ ਸਕਦੇ ਨੇ ਗਰਾਰੇ ਕੀਤੇ ਜਾ ਸਕਦੇ ਨੇ ਜਿਹਦੇ ਨਾਲ ਕਿ ਆਪਣੀ ਜਿਹੜੀ ਆਵਾਜ਼ ਆ ਉਹ ਠੀਕ ਰਹਿ ਸਕੇ ਆਪਣੀ ਆਵਾਜ਼ ਦੀ ਸੁਰੱਖਿਆ ਦੇ ਵਾਸਤੇ ਆਪਾਂ ਸਟੀਮ ਵੀ ਲੈ ਸਕਦੇ ਹਾਂ ਇਹ ਸਾਰਾ ਕੁਝ ਜੇ ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹਾਂ ਤਾਂ ਆਵਾਜ਼ ਜਿਹੜੀ ਆ ਉਹ ਠੀਕ ਰਹਿੰਦੀ ਹੈ